ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਮੈਂ ਨਾ ਪੰਜਾਬ ਟਾਈਮ ਦੇ ਨਿਊਜ਼ ਵੱਲੋਂ ਆਇਆ ਜੀ ਮੈਂ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਪੰਜਾਬ ਵਿੱਚ ਗੁਜਰਨ ਵਾਲੀਆਂ ਨਦੀਆਂ ਦੇ ਕਿਹੜੇ ਰਸਤੇ ਹਨ ਅੱਛਾ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਸਤਲੁਜ ਦਾ ਕਿਹੜਾ ਰੂਟ ਹੈ ਅੱਛਾ ਜੀ ਰਾਵੀ ਨਦੀ ਦਾ ਕਿਹੜਾ ਰੂਟ ਹੈ ਜੀ ਭਾਈ ਜੀ ਮੈਨੂੰ ਇਨਾ ਦੱਸ ਸਕਦੇ ਹੋ ਕਿ ਬਿਆਸ ਨਦੀ ਦਾ ਕਿਹੜਾ ਰੂਟ ਹੈ ਜੀ ਧੰਨਵਾਦ ਵੀਰ ਜੀ ਬਟ ਮੈਨੂੰ ਤੁਸੀਂ ਇਨਾਂ ਦੱਸ ਸਕਦੇ ਜਿਹਲਮ ਨਦੀ ਦਾ ਕਿਹੜਾ ਰੂਟ ਹੈ ਜੀ ਹੋਰ ਵੀਰੇ ਇਹ ਤਾਂ ਹੋ ਗੀਆਂ ਜੀ ਨਦੀਆਂ ਘੱਗਰ ਨਦੀ ਦਾ ਕਿਹੜਾ ਰੂਟ ਹੈ ਜੀ ਘੱਗਰ ਨਦੀ ਦਾ ਧੰਨਵਾਦ ਜੀ ਤੁਹਾਡਾ ਇਹ ਸਭ ਦੱਸਣ ਵਾਸਤੇ ਮੈਨੂੰ ਨੀ ਬਟ ਤੁਸੀਂ ਮੈਨੂੰ ਇਨਾਂ ਦੱਸ ਸਕਦੇ ਹੋ ਕਿ ਇਹ ਨਦੀਆਂ ਮਤਲਬ ਕਿਸ ਕਾਰਨ ਦੇ ਮਤਲਬ ਵੈਹ ਰਹੀਆਂ ਨੇ ਮਤਲਬ ਇਹ ਨਦੀਆਂ ਕਿੱਥੇ ਕਿੱਥੇ ਪਾਣੀ ਬਾਈ ਜੀ ਅੱਛਾ ਬਾਈ ਜੀ ਮੈਂ ਤਾਂ ਇੰਨਾ ਵੀ ਸੁਣਿਆ ਸੀ ਕਿ ਜਿਹੜੀ ਆਪਣੇ ਨੰਗਲ ਡੈਮ ਹੈ ਉੱਥੋਂ ਬਿਜਲੀ ਵੀ ਪਾਣੀ ਨਾਲ ਹੀ ਉਤਪੰਨ ਕੀਤੀ ਜਾਂਦੀ ਹੈ ਜੀ ਬਾਈ ਜੀ ਮੈਂ ਤਾਂ ਪੰਜਾਬ ਬਾਰੇ ਇਹ ਸੁਣਿਆ ਕਿ ਪੰਜਾਬ ਵਿੱਚ ਪਾਣੀ ਦੀ ਜੰਗ ਸਭ ਤੋਂ ਜ਼ਿਆਦਾ ਹੋ ਰਹੀ ਹੈ ਮੰਗ ਤਾਂ ਇਸ ਕਰਕੇ ਕਿ ਦਿੱਲੀ ਹਰਿਆਣੇ ਦੀ ਲੜਾਈ ਐਸ ਵਾਈ ਐਲ ਮੁੱਦੇ 'ਤੇ ਹੋ ਰਹੀ ਹੈ ਕੀ ਇਹ ਸੱਚ ਹੈ ਅੱਛਾ ਜੀ ਇਹ ਐਫ ਐਲ ਐਸ ਵਾਈ ਐਲ ਮੁੱਦਾ ਅੱਜ ਵੀ ਚੱਲ ਰਿਹਾ ਹੈ ਕਿ ਅੱਛਾ ਜੀ ਧੰਨਵਾਦ ਵੀਰ ਜੀ ਤੁਹਾਡਾ ਇਹ ਸਭ ਮੈਨੂੰ ਸਭ ਕੁਝ ਦੱਸਣ ਵਾਸਤੇ